ਮੇਰਾ ਨਾਮ ਨੈਨਸੀ ਹੈ ਸਾਡੇ ਖੇਤਰ ਵਿੱਚ ਵੱਖ ਵੱਖ ਸੱਭਿਆਚਾਰਿਕ ਸਮੂਹ ਰਹਿੰਦੇ ਹਨ ਜੋ ਕਿ ਬਿਹਾਰ ਯੂਪੀ ਤੋਂ ਆਏ ਹੋਏ ਹਨ ਸਾਨੂੰ ਉਹਨਾਂ ਦੀ ਹਿੰਦੀ ਭਾਸ਼ਾ ਨਹੀਂ ਸਮਝ ਆਉਂਦੀ ਤਾਂ ਸਾਨੂੰ ਹਿੰਦੀ ਵਿੱਚ ਗੱਲਬਾਤ ਕਰਨ ਲਈ ਸਾਨੂੰ ਹਿੰਦੀ ਸਿੱਖਣੀ ਪੈਂਦੀ ਹੈ ਜਾਂ ਫਿਰ ਉਹਨਾਂ ਨੂੰ ਸਾਡੀ ਗੱਲਬਾਤ ਨਾ ਸਮਝ ਆਵੇ ਤਾਂ ਉਹਨਾਂ ਨੂੰ ਪੰਜਾਬੀ ਵੀ ਸਿੱਖਣੀ ਪੈਂਦੀ ਹੈ ਜੇ ਅਸੀਂ ਹਿੰਦੀ ਨੂੰ ਸਿੱਖ ਲੈਂਦੇ ਹਾਂ ਤਾਂ ਸਾਨੂੰ ਉਹਨਾਂ ਦੀ ਭਾਸ਼ਾ ਵੀ ਸਮਝ ਆ ਜਾਂਦੀ ਹੈ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਆਸਾਨੀ ਨਾਲ ਕਰ ਸਕਦੇ ਹਾਂ ਅਤੇ ਅਸੀਂ ਉਹਨਾਂ ਨਾਲ ਸੱਭਿਆਚਾਰਿਕ ਦੀ ਤਰ੍ਹਾਂ ਗੱਲ ਕਰ ਸਕਦੇ ਹਾਂ